ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਅਗਰ ਖੇਡਾਂ ਦੇ ਆਪਾਂ ਅੰਤਰ ਬਾਰੇ ਗੱਲ ਕਰੀਏ ਤਾਂ ਜਿਹੜੇ ਪਿੰਡਾਂ ਦੇ ਲੋਕ ਹੈ ਉਹ ਨਾ ਫਿਜੀਕਲੀ ਜਿੱਥੇ ਐਫਰਟਸ ਜ਼ਿਆਦਾ ਹੁੰਦੇ ਹੈ ਫਿਜੀਕਲੀ ਜੋਰ ਜ਼ਿਆਦਾ ਲਾਉਂਦੇ ਉਹ ਵਾਲੀਆਂ ਖੇਡਾਂ ਨੂੰ ਇੰਪੋਟੈਂਸ ਜ਼ਿਆਦਾ ਦਿੰਦੇ ਹੈ ਅਗਰ ਦੂਜੇ ਪਾਸੇ ਦੇਖੀਏ ਤਾਂ ਜਿਹੜੇ ਸ਼ਹਿਰੀ ਲੋਕ ਹੈ ਉਹ ਜਿਹੜੀਆਂ ਦਿਮਾਗ ਨਾਲ ਖੇਡੀਆਂ ਜਾਂਦੀਆਂ ਖੇਡਾਂ ਬਸ ਉਹੀ ਖੇਡਾਂ ਖੇਡਦੇ ਹੈ ਬੈਠ ਕੇ ਹੋ ਗਏ ਜਾਂ ਮਤਲਬ ਇਨਡੋਰ ਗੇਮ 'ਚ ਅਸੀਂ ਕਹਿ ਲਈਏ ਕਿ ਸ਼ਹਿਰੀ ਲੋਕ ਇੰਡੋਰ ਗੇਮਸ ਨੂੰ ਜ਼ਿਆਦਾ ਪ੍ਰੈ ਪ੍ਰੈਫਰੈਂਸ ਦਿੰਦੇ ਹੈ ਅਤੇ ਜਿਹੜੇ ਪੇਂਡੂ ਲੋਕ ਹੈ ਉਹ ਆਊਟਡੋਰ ਗੇਮਸ ਵੱਲ ਜ਼ਿਆਦਾ ਭੱਜਦੇ ਹੈ ਔਰ ਫੈਸਿਲਿਟੀ ਦੀ ਗੱਲ ਕਰੀਏ ਤਾਂ ਜਿਹੜੇ ਪਿੰਡਾਂ ਦੇ ਲੋਕ ਹੈ ਉਹਨਾਂ ਨੂੰ ਫੈਸਿਲਿਟੀਜ਼ ਘੱਟ ਹੁੰਦੀਆਂ ਖੇਡਾਂ ਦੇ ਵਿੱਚ ਔਰ ਪਿੰਡਾਂ ਦੇ ਬੱਚਿਆਂ ਨੂੰ ਵੀ ਇੰਨਾਂ ਜ਼ਿਆਦਾ ਸਕੂਲਾਂ ਵਿੱਚ ਗਾਈਡ ਨਹੀਂ ਕੀਤਾ ਜਾਂਦਾ ਔਰ ਇਸਦੇ ਉਲਟ ਸ਼ਹਿਰਾਂ ਵਿੱਚ ਸ਼ਹਿਰਾਂ ਦੇ ਸਕੂਲਾਂ ਵਿੱਚ ਬੱਚਿਆਂ ਅ ਨੂੰ ਸਕੂਲ ਤੋਂ ਹੀ ਗਾਈਡ ਕੀਤਾ ਜਾਂਦਾ ਹੈ ਗੇਮਸ ਦੇ ਰਿਗਾਰਡਿੰਗ ਔਰ ਉੱਥੇ ਫੈਸਿਲਿਟੀਜ਼ ਵੀ ਬਹੁਤ ਜ਼ਿਆਦਾ ਹੁੰਦੀਆਂ